ਮੇਰਾ ਨਾਮ ਸਮਰੀਤੀ ਮੈਂ ਕੱਲ ਸ਼ਾਮੀ ਅ ਪੰਜ ਵਜੇ ਤੁਹਾਨੂੰ ਫੋਨ ਕੀਤਾ ਸੀ ਅਤੇ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮੈਂ ਕੈਬ ਬੁੱਕ ਕਰਾਉਣੀ ਔਰ ਤੁਸੀਂ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਟਾਈਮਿੰਗ ਪੁੱਛੀ ਸੀ ਮੈਂ ਤੁਹਾਨੂੰ ਉਹ ਦੱਸਿਆ ਸੀਗਾ ਕਿ ਸਵੇਰ ਨੂੰ ਅੱਠ ਵਜੇ ਸ ਸਹੀ ਅੱਠ ਵਜੇ ਉੱਥੇ ਆ ਜਿਓ ਆਪਾਂ ਜਲਦੀ ਜਾਣਾ ਜਿੱਥੇ ਪੁੱਜਣਾ ਉਥੇ ਟਾਈਮ ਨਾਲ ਪੁੱਜਣਾ ਏ ਅਤੇ ਹੁਣ ਨੌ ਵੱਜ ਚੁੱਕੇ ਆ ਅਤੇ ਬਟ ਹਜੇ ਤੱਕ ਤੁਸੀਂ ਨਹੀਂ ਆਏ ਸਾਨੂੰ ਆਪਾਂ ਤਿਆਰ ਹੋ ਕੇ ਕਦੋਂ ਦੇ ਖੜੇ ਹੋਏ ਹਾਂ ਅਤੇ ਸਾਨੂੰ ਜਾਣ ਵਿੱਚ ਵੀ ਲੇਟ ਹੋ ਰਿਹਾ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਸ ਟਾਇਮ ਤੁਸੀਂ ਕਿੱਥੇ ਹੋ ਅਗਰ ਤੁਸੀਂ ਰਾਸਤੇ ਵਿੱਚ ਹੋ ਤਾਂ ਅੱਗੇ ਹਾਈਵੇ ਦਾ ਕੰਮ ਬਣ ਰੇ ਹਾਈਵੇ ਦਾ ਕੰਮ ਬਣਨ ਵਾਲਾ ਚੱਲ ਰਿਹਾ ਤੁਸੀਂ ਉੱਧਰ ਤੋਂ ਨਾ ਆਇਓ ਅਗਰ ਤੁਸੀਂ ਉੱਧਰ ਤੋਂ ਆਏ ਤੁਸੀਂ ਵੀ ਖੱਜਲ ਹੋਊਗੇ ਅਤੇ ਤੁਹਾਡਾ ਵੀ ਟਾਈਮ ਵੇਸਟ ਹੋਵੇਗਾ ਅਤੇ ਸਾਡਾ ਵੀ ਹੋਵੇਗਾ ਆਪਾਂ ਜਿੱਥੇ ਵੀ ਜਾਣਾ ਉੱਥੇ ਜਲਦੀ ਪੁੱਜਣਾ ਅਤੇ ਤੁਸੀਂ ਉਥੋਂ ਹਾਈਵੇ ਤੋਂ ਨਾ ਆਇਓ ਉਹਦੇ ਨਾਲ ਹੀ ਲਿੰਕ ਰੋਡ ਹੈ ਤੁਸੀਂ ਉਥੇ ਤੋਂ ਆ ਸਕਦੇ ਹੋ ਜਿੱਥੇ ਜਿਸ ਨਾਲ਼ ਤੁਸੀਂ ਜਲਦੀ ਪਹੁੰਚ ਜਾਓਗੇ ਅਤੇ ਜਲਦੀ ਪਹੁੰਚ ਜਾਓਗੇ ਅਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹਉਂਗੀ ਤੁਹਾਨੂੰ ਮੈਂ ਆਪਣਾ ਐਡਰੈਸ ਕੱਲ੍ਹ ਵੀ ਦੱਸਿਆ ਸੀ ਅਗਰ ਤੁਹਾਨੂੰ ਫਿਰ ਵੀ ਨਹੀਂ ਸਮਝ ਆ ਰਿਹਾ ਜਾਂ ਤੁਹਾਨੂੰ ਨਹੀਂ ਪਤਾ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਵਟਸਐਪ 'ਤੇ ਆਪਣੀ ਲੋਕੇਸ਼ਨ ਵੀ ਭੇਜ ਦਊਂਗੀ ਅਤੇ ਅਤੇ ਅਗਰ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਆਓ ਕਿਉਂਕਿ ਆਪਾਂ ਜਿੱਥੇ ਜਾਣਾ ਉੱਥੇ ਸਾਨੂੰ ਜਾਣ 'ਚ ਵੀ ਲੇਟ ਹੋ ਰਿਹਾ ਅਗਰ ਆਪਾਂ ਟਾਈਮ ਨਾਲ਼ ਨਹੀਂ ਗਏ ਸਾਡਾ ਵੀ ਸਾਰਾ ਦਿਨ ਖਰਾਬ ਜਾਵੇਗਾ ਅਤੇ ਅਗਰ ਕੋਈ ਵੀ ਹੋਰ ਗੱਲ ਜਿਸ ਕਰਕੇ ਤੁਸੀਂ ਨਹੀਂ ਆ ਪਾ ਰਹੇ ਸਾਨੂੰ ਤੁਸੀਂ ਉਹ ਰੀਜ਼ਨ ਦੱਸ ਸਕਦੇ ਹੋ ਜਦ ਸਾਡੀ ਕੱਲ੍ਹ ਗੱਲ ਹੋਈ ਸੀ ਕਿ ਅੱਠ ਵਜੇ ਆਉਣਾ ਤਾਂ ਤੁਹਾਨੂੰ ਆਉਣਾ ਚਾਹੀਦਾ ਅਗਰ ਤੁਸੀਂ ਕੁਝ ਆਪਣੇ ਡਿਊਟੀ ਲਿਤੀ ਆ ਤਾਂ ਤੁਹਾਨੂੰ ਚੱਜ ਨਾਲ਼ ਪਰਫੋਮ ਵੀ ਕਰਨੀ ਚਾਹੀਦੀ ਹੈ ਅਗਰ ਦੂ ਦੂਜੇ ਨੂੰ ਅੱਠ ਵਜੇ ਬੋਲ ਕੇ ਅਤੇ ਨੌ ਵੱਜ ਚੁੱਕੇ ਤੁਸੀਂ ਹਾਲੇ ਤੱਕ ਨਹੀਂ ਆਏ ਆਪਾਂ ਘੰਟੇ ਤੋਂ ਖੜੇ ਹਾਂ ਨਹੀਂ ਆਉਣਾ ਹੁੰਦਾ ਤਾਂ ਸਾਨੂੰ ਪਹਿਲਾਂ ਇਨਫੋਮ ਕਰ ਦੇਣਾ ਸੀ ਆਪਾਂ ਕਿਸੇ ਹੋਰ ਟਰੈਵਲ ਕੰਪਨੀ ਨਾਲ਼ ਗੱਲ ਕਰ ਕਰ ਲੈਂਦੇ ਅਤੇ ਜਿੱਥੇ ਵੀ ਉਹ ਜਿੰਨੀ ਵੀ ਜਲਦੀ ਹੋ ਸਕੇ ਆ ਜਾਓ ਸੋ ਦੈਟ ਆਪਾਂ ਜਿੱਥੇ ਜਾਣਾ ਆਪਾਂ ਉੱਥੇ ਜਲਦੀ ਪਹੁੰਚ ਸਕੀਏ ਤਾਂ ਆਪਣਾ ਕੰਮ ਜੋ ਵੀ ਆਪਾਂ ਕਰਨਾ ਉਹ ਕਰਕੇ ਟਾਈਮ ਸਿਰ ਘਰ ਵਾਪਿਸ ਆ ਸਕੀਏ ਧੰਨਵਾਦ